ਬਚਪਨ ਤੋਂ ਲੈ ਕੇ ਮੈਂ ਤਾਰੇ ਬਹੁਤ ਦੇਖਦੀ ਸੀ ਤਾਰੇ ਮੈਨੂੰ ਬਹੁਤ ਪਸੰਦ ਸੀ ਮੈਂ ਤਾਰਿਆਂ ਦੇ ਨਾਲ ਖਾਬ ਵੀ ਸਜਾਏ ਸੀ ਕਈ ਵਾਰੀ ਤਾਂ ਇੱਦਾਂ ਲੱਗਦਾ ਸੀ ਕਿ ਮੈਂ ਤਾਰਿਆਂ ਦੀ ਦੁਨੀਆਂ ਦੇ ਵਿੱਚ ਬੈਠੀ ਹਾਂ ਹੈ ਨਾ ਜਦੋਂ ਤਾਰਾ ਟੁੱਟਦਾ ਸੀ ਅਤੇ ਮੈਂ ਵਿਸ਼ ਵੀ ਮੰਗਦੀ ਸੀ ਅਤੇ ਬੜੀਆਂ ਮ ਮਨੋਕਾਮਨਾ ਵੀ ਮੇਰੀਆਂ ਪੂਰੀਆਂ ਹੋਈਆਂ ਨੇ ਅਤੇ ਬੜੇ ਅਰਮਾਨ ਜੁੜੇ ਸੀ ਹੈ ਨਾ ਅਤੇ ਤਾਰਾ ਬੜੀ ਸੋਹਣੀ ਮਤਲਬ ਉਹਨੂੰ ਉੱਧਰ ਦੀ ਦੁਨੀਆਂਦਾਰੀ ਵੀ ਜਿੱਦਾਂ ਵੀ ਜੋ ਵੀ ਹੈ ਮੈਂ ਜੋ ਸੋਚਦੀ ਸੀ ਬਚਪਨ ਦੇ ਵਿੱਚ ਹੈ ਨਾ ਬੜੀ ਸੋਹਣੀ ਅਤੇ ਖੂਬਸੂਰਤ ਦੁਨੀਆਂ ਉੱਥੇ ਦੀ ਅਤੇ ਬਹੁਤ ਸੋਹਣਾ ਫੀਲ ਹੁੰਦਾ ਸੀ ਬਹੁਤ ਸੋਹਣਾ ਚੰਗਾ ਲੱਗਦਾ ਸੀ